ਸਤਿ ਸ਼੍ਰੀ ਕਾਲ ਭਾਅ ਜੀ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਜਾਣ ਦੇ ਲਈ ਸਵੇਰੇ ਦਸ ਵਜੇ ਔਰ ਸਵੇਰੇ ਦਸ ਵਜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਗੇਟ ਤੋਂ ਮੈਨੂੰ ਪਿਕ ਕਰ ਲਿਓ ਪਰ ਉੱਥੇ ਜਦੋਂ ਮੈਂ ਪਹੁੰਚਿਆ ਅਤੇ ਉੱਥੇ ਟ੍ਰੈਫਿਕ ਦਾ ਜਾਮ ਬਹੁਤ ਜ਼ਿਆਦਾ ਲੱਗਾ ਹੋਇਆ ਸੀ ਔਰ ਉਸ ਕਾਰਨ ਮੈਂ ਹੁਣ ਤੁਰ ਤੁਰ ਕੇ ਲਾਈਟਾਂ ਵਾਲੇ ਚੌਂਕ 'ਤੇ ਆ ਰਿਹਾਂ ਔਰ ਲਾਈਟਾਂ ਵਾਲੇ ਚੌਂਕ 'ਤੇ ਤੁਸੀਂ ਮੈਨੂੰ ਪਿਕ ਕਰਨਾ ਹੈ ਔਰ ਗੁਰਦੁਆਰੇ ਸਾਹਿਬ ਵਾਲੇ ਪਾਸੇ ਸੜਕ ਦੇ ਉੱਤੇ ਨਹੀਂ ਜਾਣਾ ਕਿਉਂਕਿ ਉੱਥੇ ਬਹੁਤ ਟਰੈਫਿਕ ਜੈਮ ਹੈ ਉੱਥੇ ਜੇ ਅਸੀਂ ਫੱਸ ਗਏ ਅਤੇ ਉੱਥੇ ਸਾਨੂੰ ਅੱਧਾ ਘੰਟਾ ਵੀ ਲੱਗ ਸਕਦਾ ਹੈ ਐਕਸਟਰਾ ਸਰ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਹੁਣ ਪੁਰਾਣੇ ਟਿਕਾਣੇ ਦੇ ਬਜਾਏ ਮੇਰਾ ਨਵਾਂ ਜਿਹੜਾ ਅੱਗੇ ਲਾਈਟਾਂ ਵਾਲਾ ਚੌਂਕ ਹੈ ਗੁਰਦੁਆਰੇ ਸਾਹਿਬ ਤੋਂ ਬਿਲਕੁਲ ਸਿੱਧੀ ਰੋਡ ਦੇ ਉੱਤੇ ਜਿਹੜਾ ਪਹਿਲਾ ਲਾਈਟਾਂ ਵਾਲਾ ਚੌਂਕ ਹੈ ਉੱਥੇ ਆ ਕੇ ਤੁਸੀਂ ਮੈਨੂੰ ਪਿੱਕ ਕਰਨਾ ਹੈ